ਮੈਂ ਆਪਣੇ ਦੋਸਤਾਂ ਨਾਲ ਫ਼ਿਲਮ ਰਾਤ ਨੂੰ ਫ਼ਿਲਮ ਦੇਖਣ ਦੀ ਯੋਜਨਾ ਬਣਾ ਰਹੇ ਸੀਗੇ ਯੋਜਨਾ ਬਣਾਉਣ 'ਚ ਓਨਲੈਨ ਅਸੀਂ ਟਿਕਟਾਂ ਬੁੱਕ ਕੀਤੀਆਂ ਟਿਕਟਾਂ ਬੁਕਿੰਗ ਵਿੱਚ ਸਾਡੀ ਸੀਟ ਨੰਬਰ ਪੰਜ ਸੌ ਇੱਕਾਹਠ ਤੋਂ ਲੈ ਕੇ ਪੰਜ ਸੌ ਪੈਂਹਠ ਤੱਕ ਸੀਗੀਆਂ ਜੋ ਕਿ ਓਨਲੈਨ ਵੀ ਸੀ ਇੰਝ ਪੜਤਾਲ ਹੋ ਰਹੀ ਹੈ ਓਨਲੈਨ ਸ਼ੋ ਨਹੀਂ ਹੋ ਰਹੀਆਂ ਮੈਂ ਆਪਣੇ ਦੋਸਤਾਂ ਨਾਲ ਇਹ ਨੰਬਰ ਸ਼ੇਅਰ ਕਰਤੇ ਅਤੇ ਉਹ ਵੀ ਮਿੰਟ ਮਿੰਟ ਦੋ ਦੋ ਮਿੰਟ ਬਾਅਦ ਚੈੱਕ ਕਰਦੇ ਰਹਿਣ ਤਾਂ ਜੋ ਆਪਣੀ ਟਿਕਟ ਸੀਟ ਬੁੱਕ ਆਪਾਂ ਨੂੰ ਕਨਫਰਮ ਹੋ ਸਕੇ